ਪਹਿਲਾਂ ਮੈਂ ਇੱਕ ਨਯਾਂ ਸਮਾਰਟਫੋਨ ਖਰੀਦਣ ਲਈ ਮੰਨ ਬਣਾਇਆ ਸੀ ਪਰ ਹੁਣ ਕਿਸੀ ਕਾਰਨ ਫੋਨ ਲੈਣ ਲਈ ਮੇਰਾ ਮਨ ਬਦਲ ਗਿਆ ਹੈ ਮੈਂ ਹੁਣ ਫੋਨ ਨਹੀਂ ਲੈਣਾ ਮੈਂ ਆਪਣੇ ਸ਼ੋਪਿੰਗ ਕਾਰਡ ਤੋਂ ਇਹਨੂੰ ਹਟਾਉਣਾ ਚਾਹੁੰਦੀ ਹਾਂ ਇਸ ਲਈ ਹੁਣ ਮੈਂ ਚਾਹੁੰਦੀ ਹਾਂ ਕਿ ਮੈਂ ਇਹਨੂੰ ਆਪਣੇ ਸ਼ੋਪਿੰਗ ਕਾਰਡ ਤੋਂ ਕਿੱਦਾਂ ਹਟਾਵਾਂ ਆਪਣੇ ਐਂਡਰਾਇਡ ਫੋਨ ਦਾ ਇਸਤੇਮਾਲ ਕਰਕੇ ਆਪਣੇ ਆਲੇ ਦੁਆਲੇ ਦੇ ਡਿਵਾਈਸ ਨੂੰ ਲੱਭ ਸਕਦੇ ਹਾਂ ਤਾਂ ਉੱਥੇ ਸੈਟ ਅਪ ਕਰ ਸਕਦੇ ਹਾਂ ਤੁਹਾਡੇ ਕੋਲ ਡਿਵਾਈਸ 'ਤੇ ਬਣਾਇਆ ਗਿਆ ਐਂਡਰਾਇਡ ਦਰਸ਼ਨ ਹੈ ਅਗਰ ਇਸ ਤਰੀਕੇ ਨਾਲ ਮਦਦ ਨਹੀਂ ਮਿਲਦੀ ਤਾਂ ਡਿਵਾਈਸ ਬਣਾਉਣ ਵਾਲੀ ਕੰਪਨੀ ਨਾਲ ਗੱਲ ਕਰੋ ਆਪਣਾ ਫੋਨ ਸੈਟ ਅਪ ਕਰੋ ਬਲੂਟੁੱਥ ਚਾਲੂ ਕਰੋ ਲੋਕੇਸ਼ਨ ਚਾਲੂ ਕਰੋ ਅਗਰ ਤੁਸੀਂ ਡਿਵਾਈਡ ਦੇ ਉੱਤੇ ਕੋਈ ਵੀ ਜਾਣਕਾਰੀ ਦੇਣੀ ਬੰਦ ਕੀਤੀ ਹੋਈ ਹੈ ਤਾਂ ਉਹਨੂੰ ਆਨ ਕਰੋ ਆਪਣੇ ਫੋਨ ਦੀ ਸਕਰੀਨ ਔਨ ਕਰੋ ਫਿਰ ਤੁਹਾਨੂੰ ਉੱਥੇ ਇੱਕ ਜਾਣਕਾਰੀ ਮਿਲੇਗੀ ਫਿਰ ਉਹਨੂੰ ਟਾਈਪ ਕਰੋ ਲੇਕਿਨ ਉਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਡਿਵਾਈਸ ਉਸ ਦੇ ਆਸ ਪਾਸ ਮੌਜੂਦ ਹੋਣਾ ਚਾਹੀਦਾ ਹੈ ਜਿੱਥੇ ਤੁਸੀਂ ਆਪਣਾ ਸੈਟ ਅਪ ਕਰਨਾ ਚਾਹੁੰਦੇ ਹੋ ਇਸ ਤਰੀਕੇ ਨਾਲ ਤੁਸੀਂ ਆਪਣਾ ਕੰਮ ਕਰ ਸਕਦੇ ਹੋ